ਜੇਕਰ ਦੇਖਿਆ ਜਾਵੇ ਭਾਰਤ ਦੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਦਾ ਜੋ ਹਾਲਾਤ ਹਨ ਉਹ ਜ਼ਿਆਦਾਤਰ ਵਧੀਆ ਨਹੀਂ ਮੰਨੇ ਜਾ ਸਕਦੇ ਕਿਉਂਕਿ ਕਿਸੇ ਵੀ ਦੇਸ਼ ਦੀ ਇਹ ਰੀੜ ਦੀ ਹੱਡੀ ਹੁੰਦੇ ਹਨ ਇੱਕ ਸਿਹਤ ਅਤੇ ਦੂਜੀ ਪੜ੍ਹਾਈ ਸਿਹਤ ਪੱਖੋਂ ਜੇਕਰ ਦੇਖਿਆ ਜਾਵੇ ਤਾਂ ਭਾਰਤ ਦੇ ਹਸਪਤਾਲ ਤਾਂ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਬਣੇ ਹੋਏ ਹਨ ਪਰ ਇਸ ਦੇ ਵਿੱਚ ਸਟਾਫ ਦੀ ਕਮੀ ਹਮੇਸ਼ਾ ਹੀ ਰੜਕਦੀ ਰਹਿੰਦੀ ਹੈ ਡਾਕਟਰਾਂ ਦੀ ਕਮੀ ਹਮੇਸ਼ਾ ਹੀ ਰੜਕਦੀ ਰਹਿੰਦੀ ਹੈ ਜ਼ਿਆਦਾਤਰ ਹਸਪਤਾਲਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਹਨ ਕਿਉਂਕਿ ਜੇ ਉੱਥੇ ਸਟਾਫ ਪੂਰਾ ਹੋਵੇ ਕਰਮਚਾਰੀ ਸਾਰੇ ਪੂਰੇ ਹੋਣ ਤਾਂ ਉਹ ਕੰਮ ਜਲਦੀ ਹੋ ਸਕਦਾ ਹੈ ਜੋ ਕਿ ਲੰਬੀਆਂ ਲਾਈਨਾਂ ਲੰਬੀਆਂ ਕਤਾਰਾਂ ਅਤੇ ਵਿੱਚ ਲੱਗ ਕੇ ਇਹ ਦਵਾਈਆਂ ਲੈਣੀਆਂ ਪੈਂਦੀਆਂ ਹਨ ਜਾਂ ਚੈਕਅਪ ਕਰਾਉਣ ਵਾਲੀਆਂ ਜਿਹੜੀਆਂ ਮਸ਼ੀਨਾਂ ਹਨ ਉਹਨਾਂ ਦੀ ਵੀ ਰਿਪੇਅਰ ਨਹੀਂ ਜ਼ਿਆਦਾਤਰ ਕੀਤੀ ਜਾਂਦੀ ਅਤੇ ਇਸ ਕਰਕੇ ਜਿਹੜੇ ਵੀ ਉੱਥੇ ਮਰੀਜ਼ ਦਵਾਈ ਲੈਣ ਜਾਂਦੇ ਹਨ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੀਆਂ ਦਿੱਕਤਾਂ ਵੀ ਆਉਂਦੀਆਂ ਹਨ ਦੂਜੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਪੂਰੀ ਦਵਾਈ ਵੀ ਉਥੋਂ ਪ੍ਰੋਪਰ ਨਹੀਂ ਮਿਲਦੀ ਜਿਸ ਕਰਕੇ ਸਾਰੇ ਮਰੀਜ਼ਾਂ ਨੂੰ ਉੱਥੇ ਦਿੱਕਤਾਂ ਆਉਂਦੀਆਂ ਰਹਿੰਦੀਆਂ ਹਨ